ਪੰਜਾਬ ਵਿੱਚ ਕਲਾ ਅਤੇ ਸ਼ਿਲਪਕਾਰੀ ਖੇਤਰ ਬਹੁਤ ਹੀ ਵਧੀਆ ਅਤੇ ਉੱਭਰ ਰਹੀਆਂ ਤਕਨੋਲੋਜੀਆਂ ਵੱਧ ਰਹੀਆਂ ਹਨ ਡਿਜ਼ੀਟਲ ਮੀਡੀਆ ਵਰਚੁਅਲ ਰਿਐਲਟੀ ਔਰ ਥ੍ਰੀ ਡੀ ਪੇਂਟਿੰਗ ਬਹੁਤ ਹੀ ਵਧੀਆ ਕਰ ਦਿੱਤਾ ਹੈ ਪਹਿਲਾਂ ਤਾਂ ਲੋਕ ਹੱਥਾਂ ਨਾਲ ਹੀ ਪੇਂਟਿੰਗ ਵਗੈਰਾ ਕਰਦੇ ਸਨ ਹੱਥਾਂ ਨਾਲ ਹੀ ਸ਼ਿਲਪਕਾਰੀ ਕਰਦੇ ਸਨ ਪਰ ਅੱਜ ਦੇ ਸਮੇਂ ਵਿੱਚ ਡਿਜ਼ੀਟਲ ਮੀਡੀਆ ਵਰਚੁਅਲ ਰਿਐਲਟੀ ਔਰ ਥ੍ਰੀ ਡੀ ਪੇਂਟਿੰਗ ਹੋਣ ਦੇ ਕਾਰਨ ਪੇਂਟਿੰਗ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ ਅੱਜ ਕੱਲ੍ਹ ਅਸੀਂ ਅਗਰ ਇੱਕ ਫੋਟੋ ਅਗ ਥ੍ਰੀ ਡੀ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਆਸਾਨੀ ਨਾਲ ਬਣਾ ਸਕਦੇ ਹਾਂ ਫਿਲਹਾਲ ਹਾਲ ਹੀ ਮੈਂ ਪੀ ਵੀ ਆਰ ਗਈ ਉੱਥੇ ਦੇਖਿਆ ਕੋਈ ਵੀ ਪੇਂਟਿੰਗ ਤੁਸੀਂ ਬਸ ਇੱਕ ਵ ਉਸਨੂੰ ਔਡਰ ਦੇ ਦਿੰਦੇ ਹੋ ਤਾਂ ਉਹ ਤੁਹਾਨੂੰ ਪੇਂਟਿੰਗ ਦੇ ਰੂਪ ਵਿੱਚ ਆਪਣੀ ਫੋਟੋ ਦੇ ਦਿੰਦਾ ਹੈ ਅਤੇ ਉੱਥੇ ਕਾਫ਼ੀ ਥ੍ਰੀ ਡੀ ਪੇਂਟਿੰਗਸ ਵੀ ਲੱਗੀਆਂ ਸਨ ਅਤੇ ਦੇਖ ਕੇ ਬਹੁਤ ਹੀ ਵਧੀਆ ਲੱਗ ਰਹੀਆਂ ਸਨ ਅਤੇ ਰੀਅਲ ਲੱਗ ਰਹੀਆਂ ਸਨ ਕਿ ਉਹ ਕਿਸ ਤਰ੍ਹਾਂ ਦੇ ਪੇਂਟਿੰਗ ਸੀਗੀਆਂ ਅਤੇ ਡਿਜੀਟਲ ਮੀਡੀਆ ਨੇ ਪੇਂਟਿੰਗ ਕਰਨਾ ਬਹੁਤ ਹੀ ਆਸਾਨ ਕਰ ਦਿੱਤਾ ਹੈ ਜੋ ਕਿ ਬਹੁਤ ਹੀ ਵਧੀਆ ਅਤੇ ਰੀਅਲ ਲੱਗਦੀਆਂ ਹਨ ਅਤੇ ਇਸ ਇਸ ਬਹੁਤ ਹੀ ਅੱਜ ਦੇ ਪੰਜਾਬ ਵਿੱਚ ਕਲਾ ਅਤੇ ਸ਼ਿਲਪਕਾਰੀ ਕਰਨੀ ਬਹੁਤ ਹੀ ਆਸਾਨ ਹੋ ਗਈ ਹੈ ਜੋ ਕਿ ਤਕਨੋਲੋਜੀ ਕਾਰਨ ਬਹੁਤ ਹੀ ਵਧੀਆ ਅਤੇ ਆਸਾਨ ਹੋ ਗਈਆਂ ਹਨ